ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਕੈਬ ਚਲਾਉਂਦੇ ਹੋ ਮੈਨੂੰ ਮੇਰੇ ਮਿੱਤਰ ਨੇ ਤੁਹਾਡਾ ਨੰਬਰ ਦਿੱਤਾ ਹੈਗਾ ਵਾ ਅਤੇ ਮੈਨੂੰ ਤੁਹਾਡੇ ਕੈਬ ਦਸ ਤਰੀਕ ਦੀ ਜ਼ਰੂਰਤ ਹੈਗੀ ਆ ਮੈਂ ਆਪਣੇ ਪਰਿਵਾਰ ਨਾਲ ਘੁੰਮਣ ਜਾਣਾ ਹੈਗਾ ਵਾ ਸ਼੍ਰੀਨਗਰ ਅਤੇ ਵਿੱਚ ਵਿੱਚ ਪਹਿਲੇ ਮਨਾਲੀ ਸਾਈਡ ਤੋਂ ਜਾਣਾ ਹੈਗਾ ਵਾ ਅਤੇ ਤਿੰਨ ਚਾਰ ਸਟੋਪ ਹੈਗੇ ਆ ਅਤੇ ਤੁਸੀਂ ਆਪਣਾ ਵੇਰਵਾ ਦੱਸ ਦਿਉ ਅਤੇ ਇਹ ਪੁੱਛਣਾ ਸੀਗਾ ਤਾਂ ਤੁਸੀਂ ਦਸ ਤਰੀਕ ਨੂੰ ਵਿਹਲੇ ਹੋ ਜੇ ਤੁਸੀਂ ਵਿਹਲੇ ਹੋ ਤਾਂ ਸਾਡਾ ਰੂਟ ਪਹਿਲੇ ਅਸੀਂ ਪਹਿਲੇ ਜਾਵਾਂਗੇ ਅੰਮ੍ਰਿਤਸਰ ਸਾਈਡ ਅੰਮ੍ਰਿਤਸਰ ਮੱਥਾ ਟੇਕ ਕੇ ਫਿਰ ਜਾਣਾ ਮਨਾਲੀ ਵਾਲੀ ਸਾਈਡ ਫੇਰ ਮਨਾਲੀ ਤੋਂ ਅਸੀਂ ਸ਼੍ਰੀਨਗਰ ਜਾਉਂਗੇ ਇਹਦੇ ਵਿੱਚ ਜਿੰਨੇ ਵੀ ਗੁਰਦੁਆਰੇ ਹੈਗੇ ਅਸੀਂ ਸਾਰੇ ਘੁੰਮਣੇ ਹੈਗੇ ਆ ਅਤੇ ਜਿੰਨੇ ਵੀ ਸਟੋਪ ਹੈਗੇ ਇਹ ਸਾਡੀ ਦੋ ਕੁ ਦਿਨਾਂ ਦੀ ਟ੍ਰਿਪ ਹੈਗੀ ਆ ਦੋ ਦਿਨਾਂ ਤੁਸੀਂ ਪੂਰਾ ਕਰ ਦਿਓ ਅਤੇ ਤੁਹਾਡਾ ਰਹਿਣ ਸਹਿਣ ਦਾ ਖਰਚਾ ਜੋ ਵੀ ਹੋਊਗਾ ਅਸੀਂ ਪੇ ਪੇਅ ਕਰ ਦਾਂਗੇ ਅਤੇ ਅਸੀਂ ਸਵੇਰੇ ਦਸ ਤਰੀਕ ਨੂੰ ਬੱਸ ਸਟੈਂਡ ਅਸੀਂ ਖੜ੍ਹੇ ਹੋਊਂਗੇ ਅਤੇ ਸਾਰਾ ਪਰਿਵਾਰ ਖੜ੍ਹੇ ਹੋਊਗਾ ਸਵੇਰੇ ਦਸ ਵਜੇ ਤਾਂ ਉੱਥੋਂ ਅਸੀਂ ਚੱਲ ਪਏਂਗੇ ਅਤੇ ਤੁਹਾਡੀ ਜੋ ਵੀ ਪੇਮੈਂਟ ਹੋਊਗੀ ਅਸੀਂ ਪੂਰੀ ਕਰ ਦੂਗੇ